ਪਠਾਨਕੋਟ ਵਿੱਚ ਬਹੁਤ ਸਾਰੇ ਮਸ਼ਹੂਰ ਸਕੂਲ ਹਨ ਜਿਵੇਂ ਕ੍ਰਾਈਸ ਦਾ ਕਿੰਗ ਕੋਨਵੇਂਟ ਸਕੂਲ ਮੋਂਟੈਸਵਰੀ ਕੈਂਬਰਿਕ ਸਕੂਲ ਅਕਾਲ ਅਕੈਡਮੀ ਸਕੂਲ ਅਤੇ ਆਰਮੀ ਪਬਲਿਕ ਸਕੂਲ ਇਹ ਸਕੂਲ ਦੀ ਆਪਣੀ ਅਲੱਗ ਅਲੱਗ ਖਾਸੀਅਤ ਹੈ ਇਨ੍ਹਾਂ ਸਕੂਲਾਂ ਦੇ ਰਿਜ਼ਲਟ ਪੂਰੇ ਪਠਾਨਕੋਟ ਵਿੱਚ ਟੋਪ 'ਤੇ ਹਨ ਕਾਫੀ ਬੱਚੇ ਇਨ੍ਹਾਂ ਸਕੂਲਾਂ ਵਿੱਚੋਂ ਪੜ੍ਹ ਕੇ ਬਹੁਤ ਵਧੀਆ ਅੱਗੇ ਆਈ ਆਈ ਟੀ ਵਿੱਚ ਗਏ ਹਨ ਇਨ੍ਹਾਂ ਦੇ ਸਕੂਲ ਦੇ ਅਧਿਆਪਕ ਬਹੁਤ ਤਜ਼ਰਬੇਦਾਰ ਅਤੇ ਪੜ੍ਹੇ ਲਿਖੇ ਹਨ ਪਰ ਇਨ੍ਹਾਂ ਸਕੂਲਾਂ ਵਿੱਚ ਐਡਮਿਸ਼ਨ ਲੈਣਾ ਕੋਈ ਮਾੜੇ ਬੰਦੇ ਦੀ ਗੱਲ ਨਹੀਂ ਹੈ ਕੋਈ ਸਰਕਾਰੀ ਮੁਲਾਜ਼ਮ ਜਾਂ ਜਿਨ੍ਹਾਂ ਦਾ ਬਹੁਤ ਤਗੜਾ ਬਿਜਨਸ ਹੋਵੇਗਾ ਉਹੀ ਇਸ ਸਕੂਲ ਵਿੱਚ ਇਨ੍ਹਾਂ ਸਕੂਲਾਂ ਵਿੱਚ ਐਡਮਿਸ਼ਨ ਲੈ ਸਕਦੇ ਹਨ ਕਿਉਂਕਿ ਇਨ੍ਹਾਂ ਸਕੂਲਾਂ ਦਾ ਫੀਸ ਸਟਕਚਰ ਬਹੁਤ ਜ਼ਿਆਦਾ ਹੈ ਜੇ ਮੈਂ ਗੱਲ ਕਰਾਂ ਪ ਪਠਾਨਕੋਟ ਦੇ ਮਸ਼ਹੂਰ ਕੋਲੇਜਾਂ ਦੀ ਤਾਂ ਉਨ੍ਹਾਂ ਵਿੱਚ ਆਰਿਆ ਪਬਲਿਕ ਮਹਿਲਾ ਕੋਲੇਜ ਸ਼੍ਰੀ ਸਾਂਈ ਕੋਲੇਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਠਾਨਕੋਟ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸੁਜਾਨਪੁਰ ਆਉਂਦੇ ਹਨ ਇਨ੍ਹਾਂ ਕੋਲੇਜਾਂ ਦਾ ਅਲੱਗ ਅਲੱਗ ਫੀਸ ਦਾ ਤਰੀਕਾ ਹੈ ਇਨ੍ਹਾਂ ਵਿੱਚੋਂ ਜੀ ਐਨ ਡੀ ਯੂ ਕੋਲੇਜ ਜਿਹੜਾ ਹੈ ਉਹ ਸਰਕਾਰੀ ਕੋਲੇਜ ਹੈ ਇਸ ਕੋਲੇਜ ਵਿੱਚ ਬਹੁਤ ਬੱਚੇ ਜਾਂਦੇ ਹਨ ਜਿਹੜੇ ਬੱਚੇ ਬੀ ਕੋਮ ਬੀ ਐਸ ਸੀ ਅਤੇ ਹੋਟਲ ਮੈਨੇਜਮੈਂਟ ਕਰਨਾ ਚਾਹੁੰਦੇ ਹਨ ਉਹ ਹਮੇਸ਼ਾ ਜੀ ਐਨ ਡੀ ਯੂ ਦੇ ਪਠਾਨਕੋਟ ਵਿੱਚ ਹੀ ਜਾਂਦੇ ਹਨ ਕਿਉਂਕਿ ਇਹ ਕੋਲੇਜ ਬਹੁਤ ਵਧੀਆ ਹੈ ਅਤੇ ਜਿਹੜੇ ਬੱਚੇ ਇੰਜੀਨੀਅਰਿੰਗ ਲਾਈਨ ਵਿੱਚ ਜਾਣਾ ਚਾਹੁੰਦੇ ਹਨ ਉਹ ਹਮੇਸ਼ਾ ਸ੍ਰੀ ਸਾਂਈ ਗਰੁੱਪ ਆਫ ਇੰਸਟੀਟਿਊਟ ਕੋਲੇਜ ਵਿੱਚ ਜਾਂਦੇ ਹਨ ਕਿਉਂਕਿ ਇੱਧਰ ਦੇ ਅਧਿਆਪਕ ਬਹੁਤ ਚੰਗੇ ਤਜ਼ਰਬੇਦਾਰ ਹਨ ਅਤੇ ਇਨ੍ਹਾਂ ਦੀ ਪਲੇਸਮੈਂਟ ਵੀ ਬਹੁਤ ਚੰਗੀ ਹੈ